ਪੰਜਾਬੀ ਭਾਸ਼ਾ ਸ਼ਾਦੀ ਮਾ ਸਾਡੀ ਮਾਤਰ ਭਾਸ਼ਾ ਹੈਗੀ ਆ ਅੱਜ ਸੰਸਾਰ ਵਿੱਚ ਸਾਡੀ ਪੰਜਾਬੀ ਭਾਸ਼ਾ ਬੋਲਣ ਲਈ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਸਾਡੇ ਸਕੂਲ ਵਿੱਚ ਅਸੀਂ ਅੱਜ ਕੱਲ੍ਹ ਪ੍ਰਾਈਵੇਟ ਸਕੂਲ ਇੰਨੇ ਹੋ ਗਏ ਹਨ ਕਿ ਜਿੱਥੇ ਵੀ ਜਾਓ ਜਿਹੜੇ ਵੀ ਸਕੂਲ ਵਿੱਚ ਜਾਓ ਸਾਰੇ ਸਕੂਲ ਇੰਗਲਿਸ਼ ਮੀਡੀਅਮ ਹੁੰਦੇ ਹਨ ਜਿੱਥੇ ਕਿ ਹਰ ਇੱਕ ਪੀਰੀਅਡ ਵਿੱਚ ਸਾਨੂੰ ਇੰਗਲਿਸ਼ ਦੇ ਪੀਰੀਅਡ ਵੀ ਇੰਗਲਿਸ਼ ਬੋਲਣੀ ਪੈਂਦੀ ਹੈ ਮੈਥ ਦੇ ਪੀਰੀਅਡ ਵਿੱਚ ਹੀ ਵੀ ਇੰਗਲਿਸ਼ ਦੀ ਹੀ ਉਹ ਵਰਤੋਂ ਹੁੰਦੀ ਹੈ ਕਿ ਸਾਡੇ ਮਤਲਬ ਕਿ ਪੰਜਾਬੀ ਬੋਲਣ ਨੂੰ ਸਾਨੂੰ ਇੰਨਾਂ ਰੋਕਦੇ ਆ ਨਾ ਕਿ ਸਾਡੀ ਜਿੰਨ ਜਿਹੜੀ ਮਾਤਰ ਭਾਸ਼ਾ ਹੈ ਉਹ ਵਰ ਘੱਟ ਤੋਂ ਘੱਟ ਘਟਾ ਦਿੱਤੀ ਗਈ ਹੈ ਜਿੱਥੇ ਦੇਖੋ ਉੱਥੇ ਹੀ ਇੰਗਲਿਸ਼ ਦੀ ਵਰਤੋਂ ਹੁੰਦੀ ਹੈ ਜਿਹਨੂੰ ਅੱਜ ਕੱਲ੍ਹ ਸਾਡੇ ਇੱਥੇ ਪੰਜਾਬ ਵਿੱਚ ਸਾਰੇ ਆਈਲੈਟਸ ਕਰਕੇ ਇੰਗਲਿਸ਼ ਸਿੱਖ ਕੇ ਅੱਗੇ ਬਾਹਰ ਕੰਟਰੀਆਂ ਵਿੱਚ ਜਾ ਰਹੇ ਆ ਜਿੱਥੇ ਉਹ ਬਾਹਰ ਜਾ ਕੇ ਵੀ ਆਪਣੀ ਮਾਤਰ ਭਾਸ਼ਾ ਭੁੱਲ ਜਾਂਦੇ ਹਨ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੀ ਮਾਤਰ ਭਾਸ਼ਾ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ ਨਾ ਕਿਸੇ ਦੇ ਬਹਿਕਾਵੇ 'ਚ ਆ ਕੇ ਆਪਣੀ ਮਾਤਰ ਭਾਸ਼ਾ ਛੱਡਣੀ ਚਾਹੀਦੀ ਹੈ ਸਾਨੂੰ ਆਪਣੀ ਮਾਤਰ ਭਾਸ਼ਾ ਜ ਸਾਰੀ ਲੈਂਗੁਏਜ ਸਿੱਖੋ ਇੰਗਲਿਸ਼ ਹਿੰਦੀ ਪੰਜਾਬੀ ਜਿੰਨੀ ਲੈਂਗੁਏਜ ਸਿੱਖਣੀ ਹੈ ਸਿੱਖੋ ਪਰ ਆਪਣੀ ਮਾਤਰ ਭਾਸ਼ਾ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਹੈ